ਅੰਮ੍ਰਿਤਸਰ ਬਹੁਤ ਸਾਰੇ ਮਹੱਤਵਪੂਰਨ ਸਥਾਨ ਹਨ ਅੰਮ੍ਰਿਤਸਰ ਵਿੱਚ ਸ਼ਹਿਰ ਵਿੱਚ ਜੋ ਕੁਝ ਵੀ ਵਾਪਰ ਰਿਹਾ ਹੈ ਜੋ ਕੁਝ ਹੋ ਰਿਹਾ ਹੈ ਇਸ ਇਹਦੀ ਸਾਰੀ ਖ਼ਬਰ ਸਾਨੂੰ ਅਖਬਾਰਾਂ ਜਿਵੇਂ ਕਿ ਅਜੀਤ ਹਿੰਦੁਸਤਾਨ ਟਾਈਮ ਅਮਰ ਉਜਾਲਾ ਜੱਗਬਾਣੀ ਪੰਜਾਬ ਕੇਸਰੀ ਇਹਨਾਂ ਚੋਂ ਸਾਨੂੰ ਪੂਰੀ ਜਾਣਕਾਰੀ ਮਿਲਦੀ ਹੈ ਸ਼ਹਿਰ ਵਿੱਚ ਕੀ ਹੋ ਰਿਹਾ ਹੈ ਕੋਈ ਕਿਸੇ ਨਾਲ ਘਟਨਾ ਵਾਪਰਦੀ ਹੈ ਜਾਂ ਕੋਈ ਸ਼ਹਿਰ ਵਿੱਚ ਨਵਾਂ ਕੋਈ ਕੰਮ ਸ਼ੁਰੂ ਹੋ ਰਿਹਾ ਹੈ ਜਾਂ ਸਰਕਾਰ ਨੇ ਕੋਈ ਅਜਿਹਾ ਕੰਮ ਕੀਤਾ ਹੈ ਜੋ ਕੁਛ ਵੀ ਸ਼ਹਿਰ ਵਿੱਚ ਵਾਪਰ ਰਿਹਾ ਆ ਉਹ ਸਾਨੂੰ ਇਹਨਾਂ ਤੋਂ ਜਾਣਕਾਰੀ ਮਿਲਦੀ ਹੈ ਕੁਝ ਵੀ ਕਿ ਮਤਲਬ ਮੀਡੀਆ ਜਾਂ ਪ੍ਰੈੱਸ ਰਿਪੋਰਟਰ ਹੈ ਉਹਨਾਂ ਤੋਂ ਸਾਨੂੰ ਬਹੁਤ ਸਾਰੀ ਜਾਣਕਾਰੀ ਮਿਲਦੀ ਹੈ ਥਾਂ ਥਾਂ 'ਤੇ ਪ੍ਰੈਸ ਰਿਪੋਰਟਰ ਜਾ ਕੇ ਉਹਨਾਂ ਮਹੱਤਵਪੂਰਨ ਸਥਾਨਾਂ ਬਾਰੇ ਜਾਣਕਾਰੀ ਦਿੰਦੇ ਹਨ ਬਹੁਤ ਹੀ ਵਧੀਆ ਤਰੀਕੇ ਨਾਲ ਉਹ ਸਾਨੂੰ ਸਭ ਕੁਝ ਦੱਸਦੇ ਆ ਸ਼ਹਿਰ ਵਿੱਚ ਕੀ ਵਾਪਰ ਰਿਹਾ ਹੈ ਮੀਡੀਆ ਹਰ ਜਗ੍ਹਾ ਪਹੁੰਚ ਜਾਂਦੀ ਹੈ ਜਿੱਥੇ ਵੀ ਕੋਈ ਘਟਨਾ ਵਾਪਰਦੀ ਹੈ ਉਹ ਉਸ ਉਸ ਦੀ ਸਾਨੂੰ ਜਾਣਕਾਰੀ ਮਿਲਦੀ ਆ ਹੋਰ ਵੀ ਬਹੁਤ ਸਾਰੇ ਪੇਜ ਹਨ ਜਿੱਥੋਂ ਸਾਨੂੰ ਇਹਨਾਂ ਬਾਰੇ ਜਾਣਕਾਰੀ ਮਿਲਦੀ ਰਹਿੰਦੀ ਹੈ ਜਿਵੇਂ ਕਿ ਯੂਟਿਊਬ ਤੋਂ ਦੇਖ ਲਓ ਜਾਂ ਫੇਸਬੁੱਕ ਦੇਖ ਲਓ ਇੰਸਟਾਗਰਾਮ ਦੇਖ ਲਓ ਇੱਥੋਂ ਸਾਨੂੰ ਬਹੁਤ ਸਾਰੀ ਜਾਣਕਾਰੀ ਮਿਲਦੀ ਰਹਿੰਦੀ ਹੈ ਸ਼ਹਿਰ ਵਿੱਚ ਜੋ ਕੁਝ ਵੀ ਵਾਪਰਦਾ ਹੈ ਉਹ ਉਸਦੀ ਜਾਣਕਾਰੀ ਬਹੁਤ ਸਾਰੀ ਸਾਨੂੰ ਮਿਲ ਜਾਂਦੀ ਹੈ ਜਿਵੇਂ ਕਿ ਤੁਹਾਡੀ ਜਿਲ ਜਿਵੇਂ ਸ਼ਹਿਰ ਵਿੱਚ ਕੋਈ ਵੀ ਸਥਾਨਕ ਖ਼ਬਰ ਹੁੰਦੀ ਹੈ ਕਿ ਟੀ ਵੀ ਚੈਨਲਾਂ 'ਤੇ ਕੇਬਲ ਥਰੂ ਵੀ ਸਾਨੂੰ ਬਹੁਤ ਸਾਰੀ ਜਾਣਕਾਰੀ ਮਿਲਦੀ ਹੈ ਜਿਵੇਂ ਸ ਗੁਰਦੁਆਰਿਆਂ ਦਾ ਲਾਈਵ ਆ ਜਾਂਦਾ ਵਾ ਸਾਰਾ ਕੁਛ ਦਰਬਾਰ ਸਾਹਿਬ ਜਿਸ ਆ ਜਾਂਦਾ ਵਾ ਸ਼ਹੀਦਾਂ ਸਾਹਿਬ ਦਾ ਲਾਈਵ ਆਉਂਦਾ ਵਾ ਕੋਈ ਵੀ ਸ਼ਹਿਰ ਚ ਘਟਨਾ ਵਾਪਰੀ ਹੈ ਜਾਂ ਕੁਛ ਵੀ ਉਹ ਸਾਨੂੰ ਕੇਬਲ ਥਰੂ ਵੀ ਪਤਾ ਚੱਲ ਜਾਂਦੀ ਹੈ ਹੋਰ ਜਿਵੇਂ ਕਿ ਜਿਹੜੇ ਪ੍ਰੈੱਸ ਰ ਵਲੋਗਰ ਆ ਵਲੋਗਰ ਜਿੱਥੇ ਵੀ ਜਾਂਦੇ ਆ ਉਹ ਹਰ ਇੱਕ ਨਵੀਂ ਚੀਜ਼ ਹੈ ਜਿੱਥੇ ਵੀ ਅੱਜ ਕੱਲ੍ਹ ਕੋਈ ਨਵੀਂ ਚੀਜ਼ ਚੱਲਦੀ ਪਈ ਆ ਵਲੋਗਰ ਸਭ ਤੋਂ ਪਹਿਲਾਂ ਉੱਥੇ ਪਹੁੰਚਦੇ ਆ ਉਹ ਜਾਣਕਾਰੀ ਦੇ ਦਿੰਦੇ ਆ ਜਿਵੇਂ ਕਿ ਪਹਿਲਾਂ ਟਰੇਨ ਚਲਣੀ ਸੀ ਬੁਲੇਟ ਟਰੇਨ ਉਸ ਦੇ ਬਾਰੇ ਬਹੁਤ ਸਾਰੀ ਚਰਚਾ ਸੀ ਬਹੁਤ ਸਾਰੀ ਜਾਣਕਾਰੀ ਮਿਲੀ ਹੁਣ ਜਿਵੇਂ ਅੰਮ੍ਰਿਤਸਰ ਹਵਾਈ ਅੱਡਾ ਸ਼ੁਰੂ ਹੋਣ ਜਾ ਰਿਹਾ ਵਾ ਹੋਇਆ ਵਾ ਉਸਦੀ ਜਾਣਕਾਰੀ ਸਾਨੂੰ ਬਹੁਤ ਸਾਰੀ ਮਿਲਦੀ ਪਈ ਆ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਵਾ ਸਾਨੂੰ ਵਲੋਗਰਾਂ ਦੇ ਥਰੂ ਵੀ ਪਤਾ ਚੱਲ ਜਾਂਦੀ ਆ ਹੁਣ ਜਿਵੇਂ ਕਿ ਦੇਖ ਲਓ ਕੁਛ ਚੀਜ਼ਾਂ ਇਸ ਤਰ੍ਹਾਂ ਦੀਆਂ ਵਾ ਥੋੜ੍ਹੀ ਜਿਹੀ ਜਿਵੇਂ ਸਫ਼ਾਈ ਸ਼ਹਿਰ ਵਿੱਚ ਗੰਦਗੀ ਗੰਦਗੀ ਬਹੁਤ ਜ਼ਿਆਦਾ ਵਾ ਇਸ ਵੱਲ ਵੀ ਮੀਡੀਆ ਨੂੰ ਥੋੜ੍ਹਾ ਜਿਹਾ ਧਿਆਨ ਦੇਣਾ ਚਾਹੀਦਾ ਅਤੇ ਇਸ ਚੀਜ਼ ਤੋਂ ਵੀ ਉਜਾਗਰ ਕਰਨਾ ਚਾਹੀਦਾ ਵਾ ਕਿ ਇਹ ਜੋ ਵੀ ਸ਼ਹਿਰ ਵਿੱਚ ਹੋ ਰਿਹਾ ਹੈ ਇਸ ਤਰ੍ਹਾਂ ਸਾਨੂੰ ਬਹੁਤ ਸਾਰੀ ਜਾਣਕਾਰੀ ਇਹਨਾਂ ਸਰੋਤਾਂ ਤੋਂ ਮਿਲ ਜਾਂਦੀ ਹੈ ਧੰਨਵਾਦ